ਸਤਿ ਸ਼੍ਰੀ ਅਕਾਲ ਜੀ ਮੈਂ ਵਰਿੰਦਰ ਸਿੰਘ ਬੋਲ਼ ਰਿਹਾ ਜਿਹੜਾ ਤੁਸੀਂ ਔਨਲਾਈਨ ਥੋਤੋਂ ਪੱਖਾ ਮੰਗਵਾਇਆ ਸੀ ਉਹ ਬਹੁਤ ਵਧੀਆ ਕੰਮ ਕਰ ਰਿਹਾ ਹੈ ਜੀ ਉਸ ਨੇ ਤਾਂ ਮੈਨੂੰ ਐਨੀ ਵਧੀਆ ਮੇਰੀ ਗਰਮੀ ਲੰਘਾਉਣੀ ਹੈ ਤਾਂ ਗੱਲ ਛੱਡ ਦਿਉ ਇਸ ਪੱਖੇ ਨੇ ਤਾਂ ਜੀ ਤੁਸੀਂ ਲਵਾਉਣ ਵਾਸਤੇ ਜਿਹੜਾ ਬੰਦਾ ਭੇਜਿਆ ਤਾ ਇਸ ਪੱਖੇ ਨੂੰ ਉਹਨੇ ਵੀ ਬੇਚਾਰੇ ਨੇ ਵਧੀਆ ਸਾਨੂੰ ਗਾਈਡ ਕਰਿਆ ਉਹਨੇ ਸਾਨੂੰ ਸਾਰੇ ਫਿਰੂਚਰਾਂ ਬਾਰੇ ਦੱਸਿਆ ਇਸ ਪੱਖੇ ਨੂੰ ਦੇਖ ਕੇ ਮੇਰੇ ਯਾਰ ਦੋਸਤ ਵੀ ਹੁਣ ਥੋਤੋ ਔਨਲਾਈਨ ਪੱਖਾ ਮੰਗਵਾਉਣਾ ਚਾਹੁੰਦੇ ਹਨ ਉਹ ਵੀ ਕਹਿੰਦੇ ਆ ਵੀ ਅਸੀਂ ਵੀ ਦੋ ਦੋ ਪੱਖੇ ਮੰਗਵਾਵਾਂਗੇ ਥੋਤੋ ਇਹ ਪੱਖਾ ਬਹੁਤ ਵਧੀਆ ਚੱਲ ਰਿਹਾ ਹੈ ਜੀ ਬਹੁਤ ਸਾਨੂੰ ਹਵਾ ਦੇ ਰਿਹਾ ਹੈ ਇਸ ਕਰਕੇ ਸਾਨੂੰ ਅਸੀਂ ਬਹੁਤ ਬਹੁਤ ਥੋਡੇ ਧੰਨਵਾਦ ਹਾਂ ਜਿਹੜਾ ਤੁਸੀਂ ਔਨਲਾਈਨ ਸਾਨੂੰ ਭੇਜਿਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ